ਸਕੂਲ ਤੋਂ ਬਾਅਦ ਜੋ ਪ੍ਰਾਈਵੇਟ ਕਲਾਸਾਂ ਨੇ ਟਿਊਸ਼ਨ ਕਲਾਸਾਂ ਵੀ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਇਹ ਵੈਸੇ ਤਾਂ ਹੋਣੀਆਂ ਨਹੀਂ ਚਾਹੀਦੀਆਂ ਕਿਉਂਕਿ ਸਕੂਲਾਂ ਵਿੱਚ ਆਪਾਂ ਆਪਣੇ ਬੱਚਿਆਂ ਨੂੰ ਭੇਜਦੇ ਹਾਂ ਪੜ੍ਹਨ ਵਾਸਤੇ ਪਰ ਅੱਜ ਕੱਲ੍ਹ ਜੋ ਪ੍ਰਾਈਵੇਟ ਸਕੂਲ ਨੇ ਉਹ ਇੱਕ ਉੱਥੇ ਪੜ੍ਹਾਈ ਘੱਟ ਕਰਵਾਈ ਜਾਂਦੀ ਹੈ ਤਾਂ ਕਿ ਟੀਚਰ ਮਤਲਬ ਕਈ ਤਰ੍ਹਾਂ ਦੀ ਇਹ ਸੋਚਦੇ ਆ ਵੀ ਸਾਡੇ ਕੋਲ ਸ਼ਾਮ ਨੂੰ ਬੱਚੇ ਟਿਊਸ਼ਨ ਆਉਣ ਅਤੇ ਅਸੀਂ ਉਹਨਾਂ ਨੂੰ ਉੱਥੇ ਪੜ੍ਹਾਵਾਂਗੇ ਕਲਾਸ ਵਿੱਚ ਉਹ ਘੱਟ ਪੜ੍ਹਾਈ ਕਰਾਉਂਦੇ ਆ ਇਸ ਲਈ ਵੀ ਟਿਊਸ਼ਨ ਕਲਾਸਾਂ ਲੋਕ ਲਗਾਉਂਦੇ ਆ ਕਿ ਤ ਸਾਡੇ ਬੱਚਿਆਂ ਦੀ ਪੜ੍ਹਾਈ ਪੂਰੀ ਹੋ ਸਕੇ ਔਰ ਅੱਜ ਕੱਲ੍ਹ ਦੇ ਹਿਸਾਬ ਨਾਲ ਕਈ ਲੋਕ ਇਸ ਲਈ ਵੀ ਲਗਾ ਦਿੰਦੇ ਆ ਕਿ ਸਾਡੇ ਬੱਚੇ ਜਿਹੜੇ ਫੋਨ 'ਤੇ ਬਹੁਤ ਜ਼ਿਆਦਾ ਬੀਜ਼ੀ ਰਹਿੰਦੇ ਆ ਉੱਥੇ ਕਲਾਸ ਵਿੱਚ ਜਾਣਗੇ ਕੁਛ ਤਾਂ ਉਹਨਾਂ ਦਾ ਕੁਛ ਟਾਈਮ ਵਾਸਤੇ ਉਹ ਫੋਨ ਤੋਂ ਦੂਰ ਰਹਿਣਗੇ ਔਰ ਟਿਊਸ਼ਨ ਕਲਾਸਾਂ ਵੈਸੇ ਜੋ ਹੈ ਉਹ ਕਮਜ਼ੋਰ ਬੱਚਿਆਂ ਵਾਸਤੇ ਹੁੰਦੀਆ ਜਿੰਨਾਂ ਨੂੰ ਕਲਾਸ ਵਿੱਚ ਜ਼ਿਆਦਾ ਬੱਚੇ ਹੋਣ ਕਰਕੇ ਸਮਝ ਨਹੀਂ ਆਉਂਦਾ ਉੱਥੇ ਥੋੜ੍ਹੇ ਬੱਚਿਆਂ ਵਿੱਚ ਉਹਨਾਂ ਦੇ ਉਹ ਚੀਜ਼ ਸਮਝ ਆ ਜਾਂਦੀ ਹੈ ਇਸ ਲਈ ਉਹਨਾਂ ਵਾਸਤੇ ਵੀ ਟਿਊਸ਼ਨ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਜ਼ਿਆਦਾ ਬੱਚਿਆਂ ਵਿੱਚ ਜਦੋਂ ਉਹਨੂੰ ਸਮਝ ਨਹੀਂ ਆਉਂਦੀ ਅਤੇ ਉਹ ਟੀਚਰ ਉਹਨੂੰ ਉਸ ਟਾਈਮ ਆਰਾਮ ਨਾਲ ਸਮਝਾ ਦਿੰਦਾ ਟਿਊਸ਼ਨ ਕਲਾਸ 'ਤੇ ਤੋ ਇਹ ਦੋਨੋ ਤਰ੍ਹਾਂ ਹੀ ਉਹ ਹੈ ਵੀ ਕਈ ਬੱਚਿਆਂ ਵਾਸਤੇ ਜ਼ਰੂਰੀ ਵੀ ਹੈ ਔਰ ਕਈਆਂ ਵਾਸਤੇ ਵੀ ਜੇ ਆਪਾਂ ਦੇਖੀਏ ਤਾਂ ਵੀ ਇਹ ਜ਼ਰੂਰੀ ਨਹੀਂ ਹੋਣੀਆਂ ਵੀ ਨਹੀਂ ਚਾਹੀਦੀਆਂ ਕਿਉਂਕਿ ਸਕੂਲਾਂ ਵਿੱਚ ਆਪਾਂ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਦੇ ਹਾਂ ਟੀਚਰਾਂ ਨੂੰ ਉੱਥੇ ਹੀ ਪੜ੍ਹਾਉਣਾ ਚਾਹੀਦਾ ਹੈ ਪਰ ਅੱਜ ਕੱਲ੍ਹ ਦੇ ਉਸ ਨੂੰ ਦੇਖਦੇ ਹੋਏ ਤਾਂ ਇਹ ਬਹੁਤ ਜ਼ਰੂਰੀ ਹੋ ਗਿਆ ਹੈ ਔਰ ਸਹੀ ਵੀ ਹੈ ਕੁਛ ਟਾਈਮ ਵਾਸਤੇ ਬੱਚਿਆਂ ਦਾ ਫੋਨ ਤੋਂ ਹੀ ਖਹਿੜਾ ਛੁੱਟਦਾ ਹੈ ਤਾਂ ਉਹ ਟਿਊਸ਼ਨ ਕਲਾਸਾਂ ਕਮਜ਼ੋਰ ਬੱਚਿਆਂ ਵਾਸਤੇ ਹੁੰਦੀਆ ਵੈਸੇ ਤਾਂ ਜ਼ਿਆਦਾਤਰ ਅਤੇ